ਮੋਬਾਈਲ ਅਤੇ ਟੀ ਵੀ ਇਹਨਾਂ ਦੀਆਂ ਮੈਨੂੰ ਲੱਗਦਾ ਹੈ ਇਹ ਜਿਹੜੀ ਟੈਕਨੋਲਜੀਆਂ ਹਨ ਇਹ ਜ਼ਿਆਦਾਤਰ ਬੱਚਿਆਂ ਨੂੰ ਮਾਨਸਿਕ ਅਤੇ ਸਰੀਰਿਕ ਪੱਖੋਂ ਖਰਾਬ ਕਰ ਰਹੀਆਂ ਹਨ ਕਿਉਂਕਿ ਕਰੋਨਾ ਟਾਈਮ ਦੇ ਸ਼ੁਰੂਆਤ ਜ਼ਿਆਦਾ ਹੋਈ ਹੈ ਬੱਚਿਆਂ ਨੂੰ ਮੋਬਾਈਲ ਦੀ ਲੱਤ ਜ਼ਿਆਦਾ ਲੱਗ ਗਈ ਸੀ ਕਰੋਨਾ ਟਾਈਮ ਦੀ ਟਾਈਮ ਕਿਉਂਕਿ ਬੱਚਿਆਂ ਨੂੰ ਸਕੂਲਾਂ ਵਿੱਚੋਂ ਜਿਹੜੀ ਪੜ੍ਹਾਈਆਂ ਹੁੰਦੀਆਂ ਸੀ ਕਲਾਸਾਂ ਲੱਗਦੀਆਂ ਸੀ ਔਨਲਾਈਨ ਕਲਾਸਾਂ ਲੱਗਦੀਆਂ ਸੀ ਉਹ ਸਾਰੇ ਮੋਬਾਈਲ ਦੇ ਉੱਪਰ ਹੀ ਲਾਉਣੀਆਂ ਪੈਂਦੀਆਂ ਅਤੇ ਉਸ ਕਾਰਨ ਜਿਹੜੇ ਤਗ ਜਿਹੜੇ ਛੋਟੇ ਬੱਚੇ ਹਨ ਪਹਿਲੀ ਦੂਜੀ ਤੀਜੀ ਕਲਾਸ ਵਿੱਚ ਪੜ੍ਹਦੇ ਹਨ ਉਹਨਾਂ ਨੂੰ ਮੋਬਾਈਲ ਦੀ ਬਹੁਤ ਬੁਰੀ ਇੱਕ ਲੱਤ ਲੱਗ ਚੁੱਕੀ ਹੈ ਜਿਹੜਾ ਕਿ ਸਾਨੂੰ ਚਿੰਤਾ ਦਾ ਵਿਸ਼ਾ ਹੈ ਉਹ ਉਹਨਾਂ ਦੇ ਸਰੀਰਿਕ ਪ੍ਰਭਾਵਾਂ ਦੇ ਉੱਪਰ ਵੀ ਪ੍ਰਭਾਵ ਕਰ ਰਹੀ ਹੈ ਸਰੀਰਾਂ ਦੇ ਉੱਪਰ ਵੀ ਪ੍ਰਭਾਵ ਕਰ ਰਹੀ ਹੈ ਕਿਉਂਕਿ ਮੋਬਾਇਲ ਦੇਖਣ ਦੇ ਨਾਲ ਉਹਨਾਂ ਨੂੰ ਅੱਖਾਂ ਦੀ ਰੌਸ਼ਨੀ ਉਹਨਾਂ ਦੀ ਘੱਟਦੀ ਜਾ ਰਹੀ ਹੈ ਨੰਬਰ ਵੱਧਦੇ ਜਾ ਰਹੇ ਨੇ ਆਈ ਚੈੱਕਅੱਪ ਸਪੈਸ਼ਲਿਸਟ ਨੂੰ ਉਹਨਾਂ ਨੂੰ ਦਿਖਾਉਣਾ ਪੈ ਰਿਹਾ ਸਟਰੈਸ ਉਹਨਾਂ ਦੇ ਦਿਮਾਗ ਦੇ ਉੱਪਰ ਜ਼ਿਆਦਾ ਚੜ੍ਹ ਰਹੀ ਹੈ ਤਾਂ ਕਿ ਉਹ ਜਦੋਂ ਕਿ ਉਹ ਡੇਲੀ ਤਿੰਨ ਤਿੰਨ ਚਾਰ ਚਾਰ ਘੰਟੇ ਮੋਬਾਇਲ ਦੇਖਦੇ ਆ ਈਵਨ ਕਿ ਉਹ ਕਿ ਖਾਣਾ ਖਾਂਦੇ ਹੋਏ ਵੀ ਬੱਚੇ ਆਪਣੇ ਮੋਬਾਈਲ ਨੂੰ ਨਾਲ ਲੈ ਕੇ ਬੈਠਦੇ ਹਨ ਜੋ ਕਿ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਮੋਬਾਈਲ ਨੂੰ ਸਾਨੂੰ ਦੂਰ ਵੱਧ ਤੋਂ ਵੱਧ ਬੱਚਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ ਅਤੇ ਇਹ ਟੈਕਨੋਲਜੀ ਨੂੰ ਸਿਰਫ ਟੈਕਨੋਲਜੀ ਹੀ ਇਹਦੀ ਵਰਤਣੀ ਚਾਹੀਦੀ ਹੈ ਇਹਦੇ ਜਿਹੜੀ ਯੂਟਿਊਬ ਹੋ ਗਿਆ ਇਹਨਾਂ ਦੇ ਫਿਲਮਾਂ ਹੋਗੀਆਂ ਵੀਡੀਓ ਹੋਗੀਆਂ ਇਹ ਸਾਨੂੰ ਬੱਚਿਆਂ ਨੂੰ ਨਹੀਂ ਦਿਖਾਉਣੀਆਂ ਚਾਹੀਦੀਆਂ